ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਮੈਨੂੰ ਕੁਲਵਿੰਦਰ ਕੌਰ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਸਰ ਮੇਰੀ ਬੇਟੀ ਦਾ ਪੇਪਰ ਚੱਲਦੇ ਪਏ ਆ ਉਹਨਾਂ ਟੈਸਟ ਦੇਣ ਜਾਣਾ ਸੀ ਅਤੇ ਮੈਂ ਇੱਕ ਤੁਹਾਡੀ ਗੱਡੀ ਬੁੱਕ ਕਰਵਾਈ ਸੀਗੀ ਪਰ ਉਹ ਟਾਈਮ ਨਾਲ ਪਹੁੰਚ ਨਹੀਂ ਸਕੀ ਮੈਂ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਲਾਗੇ ਕਰਿਆਨੇ ਦੀ ਦੁਕਾਨ ਦਾ ਐਡਰੈਸ ਦਿੱਤਾ ਸੀ ਪਰ ਉੱਥੇ ਉਹ ਪਹੁੰਚ ਨਹੀਂ ਪਾਈ ਟਾਈਮ ਨਾਲ ਸਰ ਮੇਰੀ ਰਿਕੁਐਸਟ ਹੈ ਕਿ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਲਓ ਕਿੱਥੇ ਮੈਂ ਤੁਹਾਨੂੰ ਸਾਰਾ ਅਡਰੈਸ ਉੱਥੋਂ ਦਾ ਸਮਝਾ ਦਿੰਦੀ ਹਾਂ ਸਰ ਪਲੀਜ਼ ਜਲਦੀ ਤੋਂ ਜਲਦੀ ਆਉਣਾ ਮੇਰੀ ਬੇਟੀ ਦੇ ਪੇਪ ਪੇਪਰ ਦੇਣ ਜਾਣਾ ਉਹਨਾਂ ਦੇ ਸਾਲ ਦੀ ਮਿਹਨਤ ਦਾ ਇਸ ਕਰਕੇ ਜਲਦੀ ਆ ਜਲਦੀ ਆ ਜਾਓ ਤਾਂ ਕਿ ਅਸੀਂ ਪੇਪਰ ਦੇਣ ਜਾ ਸਕੀਏ ਸਰ ਪਲੀਜ਼ ਕਿਉਂਕਿ ਅੱਗੇ ਜਾਣ ਵਾਸਤੇ ਵੀ ਟਾਈਮ ਕਾਫ਼ੀ ਲੱਗਦਾ ਹੈ ਇਸ ਕਰਕੇ ਜਲਦੀ ਤੋਂ ਜਲਦੀ ਸਰ ਪਹੁੰਚੋ ਮੈਨੂੰ ਤੁਸੀਂ ਕੋਲ ਕਰ ਲਓ ਮੈਂ ਤੁਹਾਨੂੰ ਸਾਰਾ ਐਡਰੈਸ ਸਮਝਾ ਦਿੰਦੀ ਸਰ ਓਕੇ ਸਰ ਸਤਿ ਸ਼੍ਰੀ ਅਕਾਲ ਸਰ